ਕਈ ਸਥਾਨਕ ਖੇਡਾਂ ਜਾਂ ਮਨੋਰੰਜਨ ਗਤੀਵਿਧੀਆਂ ਜੋ ਕਿ ਅੰਮ੍ਰਿਤਸਰ ਦੇ ਵਿੱਚ ਪ੍ਰਸਿੱਧ ਹਨ ਉਹ ਇਹ ਹਨ ਜਿਵੇਂ ਹੋਕੀ ਹੋ ਗਈ ਬੈਟਬੋਲ ਹੋ ਗਿਆ ਫੁੱਟਬਾਲ ਹੋ ਗਿਆ ਕ੍ਰਿਕਟ ਹੋ ਗਿਆ ਇੱਦਾਂ ਦੀਆਂ ਚੀਜ਼ਾਂ ਅੱਜ ਕੱਲ੍ਹ ਅੰਮ੍ਰਿਤਸਰ ਵਿੱਚ ਬਹੁਤ ਜ਼ਿਆਦੀਆਂ ਖੇਡੀਆਂ ਜਾ ਰਹੀਆਂ ਹਨ ਅਤੇ ਇਹ ਖਾਸ ਕਰਕੇ ਉਹਨਾਂ ਸਮਿਆਂ ਵਿੱਚ ਖੇਡੀਆਂ ਜਾਂਦੀਆਂ ਹਨ ਜਦੋਂ ਵੀ ਕਿਤੇ ਵੀ ਕੋਈ ਪ੍ਰੋਗਰਾਮ ਹੁੰਦਾ ਹੈ ਜਾਂ ਕਿਸੇ ਵੀ ਸਕੂਲ ਵਿੱਚ ਆਪਾਂ ਕੋਈ ਵੀ ਫੰਕਸ਼ਨ ਦਿਖਾਇਆ ਹੁੰਦਾ ਹੈ ਅਤੇ ਉੱਥੋਂ ਦੇ ਔਰਗਨਾਈਜ਼ਰ ਕਹਿੰਦੇ ਆ ਕਿ ਚਲੋ ਲੋਕਾਂ ਦੇ ਆਸੇ ਪਾਸੇ ਦੇ ਪਿੰਡਾਂ ਦੇ ਲੋਕ ਆ ਸਕਣ ਅਤੇ ਇੱਥੇ ਮਿਲਣ ਇੰਜੋਏ ਕਰ ਸਕਣ ਦੇ ਨਾਲ ਖੇਡਾਂ ਦਾ ਆਨੰਦ ਮਾਣ ਸਕਣ ਅਤੇ ਇਹ ਕੁਝ ਖਾਸ ਗੱਲਾਂ ਹੁੰਦੀਆਂ ਨੇ ਜਿਹਨਾਂ ਕਰਕੇ ਲੋਕ ਇਕੱਠੇ ਹੋ ਜਾਂਦੇ ਹਨ ਅਤੇ ਆਪਸ ਵਿੱਚ ਕਈ ਸ਼ਰਤਾਂ ਵੀ ਲਗਾ ਲੈਂਦੇ ਹਨ ਕਿ ਸਾਡੀ ਟੀਮ ਜਿੱਤੇਗੀ ਦੂਸਰੀ ਟੀਮ ਕਹਿੰਦੀ ਹੈ ਕਿ ਸਾਡੀ ਟੀਮ ਜਿੱਤੇਗੀ ਬੱਸ ਇਹੀ ਗੱਲਾਂ ਬਾਤਾਂ ਹੁੰਦੀਆਂ ਉਹਨਾਂ ਸਥਾਨਕ ਖੇਡਾਂ ਵਿੱਚ ਅਤੇ ਲੋਕ ਆਪਣੇ ਭਾਵਨਾਵਾਂ ਵੀ ਇੱਕ ਦੂਜੇ ਨਾਲ ਸਾਂਝੀਆਂ ਕਰਦੇ ਹਨ ਕਿ ਅਸੀਂ ਆਪਣੇ ਜ਼ਮਾਨੇ ਵਿੱਚ ਇੱਦਾਂ ਖੇਡਦੇ ਹੁੰਦੇ ਸਾਂ ਉੱਦਾਂ ਖੇਡਦੇ ਹੁੰਦੇ ਸਾਂ ਸੋ ਇਹੀ ਅੰਮ੍ਰਿਤਸਰ ਵਿੱਚ ਖੇਡਾਂ ਖੇਡੀਆਂ ਜਾਂਦੀਆਂ ਹਨ ਅੱਜ ਕੱਲ੍ਹ ਬਾਕੀ ਲੋਕ ਅੱਜ ਕੱਲ੍ਹ ਘਰਾਂ ਵਿੱਚ ਵੀ ਬੈਟ ਬੋਲ ਖੇਡਦੇ ਹਨ ਜਿਹੜਾ ਕਿ ਬਹੁਤ ਵਧੀਆ ਲੱਗਦਾ ਹੈ